ਮੈਨੂੰ ਵੱਖ ਵੱਖ ਥਾਵਾਂ 'ਤੇ ਹਾਈਕਿੰਗ ਕਰਨਾ ਬਹੁਤ ਪਸੰਦ ਹੈ ਪਰ ਮੇਰੀ ਸਭ ਤੋਂ ਮਨ ਪਸੰਦ ਜਗ੍ਹਾ ਹਿਮਾਚਲ ਹੈ ਇੱਥੋਂ ਦੇ ਪਹਾੜਾਂ ਦੀ ਗੱਲ ਹੀ ਨਿਰਾਲੀ ਹੈ ਇਸ ਖੇਤਰ ਵਿੱਚ ਆਸਾਨ ਟਰੈਲਾਂ ਤੋਂ ਲੈ ਕੇ ਔਖੇ ਵਾਲੇ ਟਰੈਕ ਤੱਕ ਸਭ ਮੌਜੂਦ ਹੈ ਪਰ ਇਸ ਦਾ ਸਭ ਤੋਂ ਸੁੰਦਰ ਅਨੁਭਵ ਜਦੋਂ ਤੁਸੀਂ ਥੱਕ ਹਾਰ ਕੇ ਟਰੈਕਿੰਗ ਕਰਕੇ ਪਹਾੜ ਦੀ ਚੋਟੀ ਦੇ ਪੁੱਜਦੇ ਹਾਂ ਸੂਰਜ ਜੋ ਦਿਨ ਭਰ ਤੁਹਾਡਾ ਸਾਥੀ ਹੁੰਦਾ ਹੈ ਆਪਣਾ ਉਤਰਨਾ ਸ਼ੁਰੂ ਕਰਦਾ ਹੈ ਇਹ ਸਿਰਫ ਹੇਠਾਂ ਨਹੀਂ ਜਾਂਦਾ ਪਰ ਇੱਕ ਸ਼ੋਅ ਪੇਸ਼ ਕਰਦਾ ਹੈ ਅਸਮਾਨ ਹੌਲੀ ਹੌਲੀ ਨਰਮ ਗੁਲਾਬੀ ਅਤੇ ਜਾਮਨੀ ਰੰਗਾਂ ਵਿੱਚ ਮਿਲ ਜਾਂਦਾ ਹੈ ਅਤੇ ਇੱਕ ਨਜ਼ਾਰਾ ਜੋ ਸਿਰਫ ਸਕੂਨ ਹੀ ਨਹੀਂ ਦਿੰਦਾ ਪਰ ਜੀਵਨ ਦਾ ਅਸਲੀ ਆਨੰਦ ਦਿੰਦਾ ਹੈ ਇਹ ਸਾਡੇ ਦਿਨ ਦੀ ਯਾਤਰਾ ਦੀ ਸਮਾਪਤੀ ਹੈ ਕੁਦਰਤ ਨਾਲ ਇੱਕ ਡੂੰਘਾ ਸੰਬੰਧ ਇੱਕ ਸਫਲਤਾ ਦੀ ਭਾਵਨਾ ਹੁੰਦੀ ਹੈ ਜੋ ਸਾਡੇ ਨਾਲ ਜ਼ਿੰਦਗੀ ਭਰ ਰਹਿੰਦੀ ਹੈ